ਭਾਰਤ ਵਿੱਚ ਬਹੁਤ ਤਰ੍ਹਾਂ ਦੇ ਭੋਜਨ ਪਾਏ ਜਾਂਦੇ ਹਨ ਜਿਵੇਂ ਕਿ ਸਾਊਥ ਵਿੱਚ ਡੋਸਾ ਹੋ ਗਿਆ ਸਾਂਬਰ ਇਡਲੀ ਰਸਮ ਮਸਾਲਾ ਡੋਸਾ ਪੋਹਾ ਇਸ ਦੀ ਵਰਤੋਂ ਬਹੁਤ ਹੀ ਜ਼ਿਆਦਾ ਕੀਤੀ ਜਾਂਦੀ ਹਨ ਅਤੇ ਲੋਕਾਂ ਵਿੱਚ ਸਵੇਰ ਨੂੰ ਖਾਣ ਵਾਸਤੇ ਉਪਮਾ ਹੋ ਗਿਆ ਪੋਹਾ ਹੋ ਗਿਆ ਬਹੁਤ ਹੀ ਪ੍ਰਸਿੱਧ ਹੈ ਅਤੇ ਲੋਕ ਸ਼ਾਮ ਵਾਸਤੇ ਚਿਕਨ ਵੀ ਖਾਂਦੇ ਹਨ ਜੋ ਕਿ ਉਹਨਾਂ ਦੀ ਸਿਹਤ ਲਈ ਬਹੁਤ ਹੀ ਵਧੀਆ ਹੈ ਗੱਲ ਕਰੀ ਜਾਵੇ ਪੰਜਾਬ ਵਿੱਚ ਪੰਜਾਬ ਦੇ ਲੋਕ ਜਿਵੇਂ ਕਿ ਸਰਦੀਆਂ ਵਿੱਚ ਸਰ੍ਹੋਂ ਦਾ ਸਾਗ ਹੀ ਬਹੁਤ ਇੰਜੁਆਏ ਕਰਦੇ ਹਨ ਅਤੇ ਉਸ ਨੂੰ ਬਣਾਉਣ ਵਾਸਤੇ ਵੀ ਹੀ ਇੱਕ ਅਲੱਗ ਅਲੱਗ ਤਰੀਕਾ ਹੈ ਲੋਕ ਪਹਿਲਾਂ ਸਾਗ ਨੂੰ ਕੱਟਦੇ ਹਨ ਅਤੇ ਉਸ ਨੂੰ ਫਿਰ ਕੜਾਹੀ ਵਿੱਚ ਪਾ ਕੇ ਉਸ ਨੂੰ ਉਬਾਲ ਦਿੰਦੇ ਹਨ ਅਤੇ ਉਸ ਨੂੰ ਘੱਟੋ ਘੱਟ ਇੱਕ ਘੰਟਾ ਉਬਾਲਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਆਟਾ ਪਾ ਕੇ ਆਲਣ ਲਗਾਇਆ ਜਾਂਦਾ ਹੈ ਅਤੇ ਜਿਸ ਨਾਲ ਸਾਡਾ ਸਾਗ ਤਿਆਰ ਹੋ ਜਾਂਦਾ ਹੈ ਅਤੇ ਉਸ ਵਿੱਚ ਅਸੀਂ ਮੱਖਣ ਜਾਂ ਹੋਰ ਦੇਸੀ ਘਿਓ ਪਾ ਕੇ ਉਸ ਨੂੰ ਮੱਕੀ ਦੀ ਰੋਟੀ ਨਾਲ਼ ਖਾਂਦੇ ਹਨ ਅਤੇ ਕਈ ਲੋਕ ਇਸਦੇ ਨਾਲ਼ ਲੱਸੀ ਵੀ ਪੀਂਦੇ ਹਨ ਅਤੇ ਬਹੁਤ ਹੀ ਇੰਜੁਆਏ ਕਰਦੇ ਹਨ ਇਹ ਹੈ ਜੋ ਕਿ ਬਹੁਤ ਪ੍ਰਸਿੱਧ ਪੰਜਾਬ ਵਿੱਚ ਮੰਨਿਆ ਜਾਂਦਾ ਹੈ ਅਤੇ ਹੋਰ ਵੀ ਅਨੇਕ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਜਾਂਦੇ ਹਨ ਜਿਵੇਂ ਸ਼ਾਹੀ ਪਨੀਰ ਹੋ ਗਿਆ ਹੋਰ ਵੀ ਸ਼ਾਹੀ ਪਨੀਰ ਦੇ ਨਾਲ਼ ਦੇ ਨਾਲ਼ ਆਲੂ ਮਟਰ ਦੀ ਸਬਜ਼ੀ ਵੀ ਬਹੁਤ ਹੀ ਪ੍ਰਸਿੱਧ ਹੈ ਅਤੇ ਪਕੌੜਿਆਂ ਦੇ ਨਾਲ਼ ਉਸਨੂੰ ਖਾਇਆ ਜਾਂਦਾ ਹੈ ਸੋ ਇਹ ਸਨ ਜੋ ਕਿ ਭਾਰਤ ਵਿੱਚ ਬਹੁਤ ਹੀ ਪ੍ਰਸਿੱਧ ਭੋਜਨ ਹਨ ਅਤੇ ਲੋਕਾਂ ਵਿੱਚ ਬਹੁਤ ਹੀ ਦਿਲਚਸਪੀ ਇਸਨੂੰ ਖਾਣ ਵਿੱਚ ਮਹਿਸੂਸ ਕਰਦੇ ਹਨ